ਇੱਕ ਨਵਜੰਮੇ ਬੱਚੇ ਲਈ ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਜੋ ਜੋ ਇੱਕ ਨਵਜੰਮਾ ਬੱਚਾ ਮੁੰਡਾ ਜਾਂ ਕੁੜੀ ਜਨਮ ਲੈਂਦੇ ਹੈ ਤਾਂ ਉਨ੍ਹਾਂ ਲਈ ਬਹੁਤ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਇੱਕ ਮੁੰਡੇ ਦਾ ਜਨਮ ਲੈਣ ਤੋਂ ਮਗਰੋਂ ਉਸਦੇ ਲੱਡੂ ਵੰਡੇ ਜਾਂਦੇ ਹਨ ਲੋਹੜੀਆਂ ਪਾਈਆਂ ਜਾਂਦੀਆਂ ਹਨ ਅਤੇ ਦੀ ਦੀਵਾਲੀ ਵੀ ਵਧੀਆ ਤਰੀਕੇ ਨਾਲ਼ ਮਨਾਈ ਜਾਂਦੀ ਹੈ ਉਸ ਦਾ ਨਾਮਕਰਨ ਕੀਤਾ ਜਾਂਦਾ ਹੈ ਜਦੋਂ ਇੱਕ ਕੁੜੀ ਜਨਮ ਲੈਂਦੀ ਹੈ ਭਾਵ ਨਵਜੰਮੀ ਬੱਚੀ ਦੇ ਜਨਮ ਤੋਂ ਬਾਅਦ ਉਸਦੀ ਉਸ ਦੇ ਵੀ ਲੱਡੂ ਵੰਡੇ ਜਾਂਦੇ ਹਨ ਨਾਮਕਰਨ ਕੀਤਾ ਜਾਂਦਾ ਹੈ ਫਿਰ ਉਨ੍ਹਾਂ ਦਾ ਮੱਥਾ ਟਿਕਾਇਆ ਜਾਂਦਾ ਹੈ ਅਤੇ ਉਹਨਾਂ ਦੀਆਂ ਚਾਵਾਂ ਦੇ ਨਾਲ਼ ਲੋਹੜੀਆਂ ਵੀ ਪਾਈਆਂ ਜਾਂਦੀਆਂ ਹਨ ਸਾਡੇ ਸਮਾਜ ਵਿੱਚ ਕੁੜੀਆਂ ਮੁੰਡੇ ਜੋ ਵੀ ਜਨਮ ਲੈਂਦੇ ਹਨ ਉਹਨਾਂ ਦਾ ਬਹੁਤ ਹੀ ਚਾਅ ਅਤੇ ਲਾਡ ਕੀਤੇ ਜਾਂਦੇ ਹਨ